ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਰਤ ਦੇ ਫੈਸ਼ਨ ਬਾਰੇ ਮੈਂ ਸੋਚਦਾ ਹਾਂ ਕਿ ਭਾਰਤ ਦਾ ਫ਼ੈਸ਼ਨ ਜਿਹੜਾ ਹੈਗਾ ਉਹ ਮੋਡਰਕਨਾਈਜੇਸ਼ਨ ਜਿਹੜੀ ਆਈ ਹੈਗੀ ਆ ਉਹ ਸਾਡੇ ਇੱਥੇ ਤਾਂ ਉਹਦੇ ਨਾਲ ਉਹਨੇ ਸਾਡੀ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕੀਤਾ ਸਾਡਾ ਸੋਚਣ ਦਾ ਢੰਗ ਤਰੀਕਾ ਸਾਡਾ ਜਿਊਣ ਸਾਡੀ ਭਾਸ਼ਾ ਸਾਡਾ ਖਾਣ ਪੀਣ ਪਹਿਰਾਵਾ ਹਰ ਚੀਜ਼ ਪ੍ਰਭਾਵਿਤ ਹੋਈ ਹੈ ਅਤੇ ਬਾਕੀ ਸਾਰੀਆਂ ਚੀਜ਼ਾਂ ਦੇ ਪ੍ਰਭਾਵਿਤ ਹੋਣ ਦੇ ਨਾਲ ਪਹਿਰਾਵੇ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਸੀਗਾ ਅਤੇ ਭਾਰਤ ਦਾ ਜਿਹੜਾ ਫ਼ੈਸ਼ਨ ਜਿਹੜਾ ਹੈਗਾ ਏ ਆ ਉਹ ਉਹ ਫ਼ੈਸ਼ਨ ਦੇ ਵਿੱਚ ਅਸੀਂ ਮੌਟੇ ਤੌਰ 'ਤੇ ਅਸੀਂ ਪਹਿਰਾਵੇ ਨੂੰ ਲੈ ਲੈਂਦੇ ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਫ਼ੈਸ਼ਨ ਰਿਵਾਜ਼ ਜਿਹਨੂੰ ਅਸੀਂ ਕਹਿ ਲੀਏ ਬਹੁਤ ਸਾਰੇ ਤਰ੍ਹਾਂ ਦੇ ਰਿਵਾਜ਼ ਜਿਹੜੇ ਹੈਗੇ ਉਹ ਬਦਲੇ ਅਤੇ ਉਹਦੇ 'ਚ ਪਹਿਰਾਵਾ ਵੀ ਬਦਲਿਆ ਅਤੇ ਪਹਿਰਾਵਾ ਭਾਰਤ ਦਾ ਜਿਹੜਾ ਹੈਗਾ ਸੀ ਮਤਲਬ ਜਿਹੜਾ ਹੈਗਾ ਉਹ ਵੈਸਟਰਨ ਜਿਹੜਾ ਹੈਗਾ ਪੱਛਮੀ ਪਹਿਰਾਵਾ ਜਿਹੜਾ ਹੈਗਾ ਉਹਨੂੰ ਪਹਿਨਣ ਦੇ ਵਿੱਚ ਜ਼ਿਆਦਾ ਜਿਹੜਾ ਮਾਣ ਮਹਿਸੂਸ ਕਰਦੇ ਹਾਂ ਜ਼ਿਆਦਾ ਅਸੀਂ ਉਹਦੇ ਵਿੱਚ ਮੋਡਰਨ ਆਧੁਨਿਕ ਮਹਿਸੂਸ ਕਰਦੇ ਹਾਂ ਆਪਣੇ ਆਪ ਨੂੰ ਤਾਂ ਉਹਦੇ ਵਿੱਚੋਂ ਪੈਂਟਾਂ ਕੁਝ ਸ਼ਰਟਾਂ ਜਿਹੜੀਆਂ ਹੈਗੀਆਂ ਨੇ ਜਾਂ ਮਤਲਬ ਜਿਹਨੂੰ ਕਿ ਟੋਪਸ ਵਗੈਰਾ ਮਤਲਬ ਜਿਹੜੇ ਹੈਗੇ ਨੇ ਕੁੜੀਆਂ ਜਿਹੜੀਆਂ ਨੇ ਜੀਨਸ ਅਤੇ ਟੋਪਸ ਪਾਉਣਾ ਪਸੰਦ ਕਰਦੀਆਂ ਨੇ ਮੁੰਡੇ ਵੀ ਫੋਰਮਲ ਡਰੈਸਿਸ ਜਿਹੜੀਆਂ ਨੇ ਉਹ ਪਸੰਦ ਕਰਦੇ ਹੈਗੇ ਤਾਂ ਇਹ ਤਾਂ ਸਹਿਜ ਹੈ ਗੱਲ ਕਿ ਪੱਛਮੀ ਫ਼ੈਸ਼ਨ ਨੇ ਭਾਰਤ ਦੇ ਫ਼ੈਸ਼ਨ ਨੂੰ ਜਿਹੜਾ ਉਹ ਪ੍ਰਭਾਵਿਤ ਕੀਤਾ ਉਹਦੇ ਵਿੱਚੋਂ ਜਿਹੜਾ ਸਾਡਾ ਆਪਣਾ ਇੱਥੋਂ ਦਾ ਮੂਲ ਪਹਿਰਾਵਾ ਸੀਗਾ ਰਵਾਇਤੀ ਪਹਿਰਾਵਾ ਸੀਗਾ ਉਹਨੂੰ ਛੱਡ ਕੇ ਅਸੀਂ ਪੱਛਮ ਕਿਉਂਕਿ ਪੱਛਮ ਜਿਹੜਾ ਹੈਗਾ ਆ ਉੱਥੇ ਮੋਡਰਨਲਾਇਜੇਸ਼ਨ ਦੀ ਸ਼ੁਰੂਆਤ ਹੋਈ ਅਤੇ ਉੱਥੋਂ ਦਾ ਕੁੱਲ ਜੀਵਨ ਢੰਗ ਹੈ ਜਿਹੜਾ ਉਹਨੇ ਜਿਹੜਾ ਆਪਣਾ ਪ੍ਰਭਾਵ ਦੁਨੀਆਂ ਦੇ ਉੱਤੇ ਛੱਡਿਆ ਅਤੇ ਉਹ ਭਾਰਤ ਦੇ ਉੱਤੇ ਵੀ ਛੱਡਿਆ ਅਤੇ ਭਾਰਤ ਨੇ ਜਿਹੜਾ ਉਹ ਪ੍ਰਭਾਵ ਕਬੂਲਿਆ ਪੱਛਮ ਦਾ ਉਹਦੇ ਵਿੱਚੋਂ ਅਸੀਂ ਅਪਣੀ ਰ ਆਪਣੇ ਰਵਾਇਤੀ ਪਹਿਰਾਵੇ ਨੂੰ ਛੱਡ ਕੇ ਜਾਂ ਉਹਨੂੰ ਘਟਾ ਕੇ ਜਿਹੜਾ ਹੈਗਾ ਉਹ ਪੱਛਮ ਦੇ ਲੋਕਾਂ ਵੱਲੋਂ ਪਹਿਨੇ ਜਾਂਦੇ ਪਹਿਰਾਵੇ ਨੂੰ ਪਹਿਨਣ ਦੇ ਵਿੱਚ ਜ਼ਿਆਦਾ ਤਰਜੀਹ ਦਿੱਤੀ ਇਹਦੇ ਵਿੱਚ ਜੀਨ ਟੋਪ ਟੀ ਸ਼ਰਟਸ ਅਤੇ ਫੋਰਮਲ ਜਿਹੜੀਆਂ ਨੇ ਆ ਜਾਂਦੀਆਂ ਹੈਗੀਆਂ ਅਤੇ ਜੇ ਤੁਸੀਂ ਮੇਰੀ ਪਸੰਦ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਮੈਂ ਜ਼ਿਆਦਾਤਰ ਰਵਾਇਤੀ ਪਹਿਰਾਵਾ ਪਹਿਨਣਾ ਪਸੰਦ ਕਰਦਾਂ ਉਹਦਾ ਕਾਰਨ ਇਹ ਹੈ ਕਿ ਇੱਕ ਤਾਂ ਉਹ ਅਸੀਂ ਆਪਣੀ ਪਹਿਰਾਵਾ ਜਿਹੜਾ ਹੈਗਾ ਆ ਉਹ ਉਹ ਸਾਡਾ ਆਪਣਾ ਸਾਡੀ ਰਵਾਇਤ ਦੇ ਵਿੱਚੋਂ ਸਾਡੇ ਕੋਲ ਆਇਆ ਉਹਨੂੰ ਪਹਿਨਣਾ ਸਾਡੇ ਵਾਸਤੇ ਵਧੇਰੇ ਮਾਣ ਦੀ ਗੱਲ ਹੈ ਕੋਈ ਵੀ ਪਹਿਰਾਵਾ ਆਪਾਂ ਇਹ ਨਹੀਂ ਕਹਿੰਦੇ ਕਿ ਪੱਛਮ ਦਾ ਪਹਿਰਾਵਾ ਜਿਹੜਾ ਹੈਗਾ ਅਸੀਂ ਉਹਨੂੰ ਪਸੰਦ ਨਹੀਂ ਕਰਦੇ ਅਸੀਂ ਉਹਨੂੰ ਡਿਸਲਾਈਕ ਕਰਦੇ ਨਹੀਂ ਉਹ ਵੀ ਵਧੀਆ ਪਰ ਸਾਡੀ ਪ੍ਰੈਫਰੈਂਸ ਜਿਹੜੀ ਸਾਡੀ ਤਰਜੀਹ ਜਿਹੜੀ ਹੈਗੀ ਹੈ ਮੇਰੀ ਨਿੱਜੀ ਤੌਰ 'ਤੇ ਉਹ ਰਵਾਇਤੀ ਪਹਿਰਾਵੇ ਨੂੰ ਆ ਅਤੇ ਉਹਦਾ ਕਾਰਨ ਇਹ ਹੈ ਕਿ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜਾ ਜਿਹੜੀ ਪੱਛਮੀ ਪਹਿਰਾਵਾ ਉਹ ਸਾਨੂੰ ਮਤਲਬ ਕਿ ਬ ਬਾਹਰੋਂ ਖਰੀਦਣਾ ਪੈਂਦਾ ਜਾ ਕੇ ਅਤੇ ਪਰ ਕਈ ਵਾਰੀ ਓਫੀਸ਼ੀਅਲ ਪਲੈਸਿਸ ਦੇ ਉੱਤੇ ਸਾਨੂੰ ਜਿਹੜਾ ਹੈਗਾ ਉਹ ਪੈਂਟ ਸ਼ਰਟ ਵਗੈਰਾ ਵੀ ਪਾਉਣੀ ਪੈਂਦੀ ਹੈ ਪਰ ਮੈਂ ਰਵਾਇਤੀ ਪਹਿਰਾਵਾ ਪਹਿਨਣ ਦੇ ਵਿੱਚ ਕੁੜਤਾ ਚਾਦਰਾ ਕੁੜਤਾ ਪਜਾਮਾ ਪਹਿਨਣਾ ਪਸੰਦ ਕਰਦਾ ਹੈਗਾ ਹਾਂ ਪੱਗ ਬੰਨਣੀ ਪਸੰਦ ਕਰਦਾ ਹੈਗਾ ਹਾਂ ਪਰ ਜਿਹੜੀਆਂ ਕੁਛ ਪੈਂਟ ਸ਼ਰਟਸ ਵਗੈਰਾ ਫੋਰਮਲਸ ਪਾਉਣੀਆਂ ਪੈਂਦੀਆਂ ਤਾਂ ਮੈਂ ਜ਼ਿਆਦਾਤਰ ਉਹਨਾਂ ਨੂੰ ਮੌਲਸ ਦੇ ਵਿੱਚੋਂ ਖਰੀਦਣਾ ਪਸੰਦ ਕਰਦਾ ਹਾਂ